ਸਾਡੇ ਪੰਜਾਬ ਵਿੱਚ ਤਿੰਨ ਤਿੰਨ ਤਰ੍ਹਾਂ ਦੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਜਿਨ੍ਹਾਂ 'ਚ ਮਾਝਾ ਮਾਲਵਾ ਮਾਲਵਈ ਅਤੇ ਦੁਆਬਾ ਇਨ੍ਹਾਂ ਦੇ ਵਿੱਚ ਕੋਈ ਖ਼ਾਸਾ ਫ਼ਰਕ ਤਾਂ ਹੈ ਨਹੀਂ ਪਰ ਇਹਨਾਂ ਦੇ ਸ਼ਬਦਾਂ ਵਿੱਚ ਕੁਝ ਫ਼ਰਕ ਹੈ ਜਿਵੇਂ ਕਿ ਪੰਜਾਬ ਹੈ ਸਾਡੇ ਮੇਰਾ ਇਲਾਕਾ ਬਠਿੰਡਾ ਹੈ ਅਤੇ ਬਠਿੰਡੇ ਵਿੱਚ ਕਿਸੇ ਨੂੰ ਬਲਾਉਣ ਸਮੇਂ ਬਾਈ ਜੀ ਕਹਿ ਕੇ ਬੁਲਾਇਆ ਜਾਂਦਾ ਹੈ ਅਤੇ ਉੱਧਰ ਦੂ ਦੂਜੇ ਪਾਸੇ ਮ ਮਾਝੇ ਵਿੱਚ ਇਸ ਨੂੰ ਕਿਹਾ ਮਤਲਬ ਕਿਹਾ ਜਾਂਦਾ ਕਿ ਵੀਰੇ ਉਰੇ ਆਈ ਜਾਂ ਕਿਵੇਂ ਭਰਾ ਹੋਰ ਗੱਲ ਸੁਣੀ ਇੱਦਾਂ ਦੇ ਭਾਸ਼ਾ ਦੇ ਸ਼ਬਦਾਂ ਵਿੱਚ ਇਹ ਹੀ ਫ਼ਰਕ ਹੁੰਦਾ ਹੈ ਇਸ ਤਰ੍ਹਾਂ ਦੁਆਬੇ ਵਿੱਚ ਵੀ ਥੋੜ੍ਹਾ ਬਹੁਤਾ ਫ਼ਰਕ ਹੁੰਦਾ ਹੈ ਅਤੇ ਇਸ ਤਰ੍ਹਾਂ ਮਾਲਵੇ ਵਿੱਚ ਫ਼ਰਕ ਹੁੰਦਾ ਹੈ ਪਰ ਪੰਜਾਬੀ ਮੈਂ ਬਠਿੰਡੇ ਦਾ ਵਸਨੀਕ ਹੋਣ ਕਰਕੇ ਮੈਨੂੰ ਸਿਰਫ਼ ਮਲਵਈ ਭਾਸ਼ਾ ਹੀ ਆਉਂਦੀ ਹੈ ਹੋਰ ਕੋਈ ਭਾਸ਼ਾ ਨਹੀਂ ਸਿੱਖੀ ਅਤੇ ਇਹ ਹੀ ਮੇਰੀ ਖੇਤਰੀ ਭਾਸ਼ਾ ਹੈ ਮੈਂ ਹਰੇਕ ਪੰਜਾਬੀ ਸਾਡੇ ਪੰਜਾਬ ਵਿੱਚ ਅਲੱਗ ਅਲੱਗ ਭਾਸ਼ਾ ਹੈ ਅਤੇ ਜੋ ਕਿ ਸ਼ਬਦਾਂ ਦੇ ਹੇਰ ਫਿਰ ਨਾਲ ਹੀ ਬਦਲੀ ਜਾਂਦੀ ਹੈ ਸ਼ਬਦਾਂ ਦੇ ਹੇਰ ਫਿਰ ਤੋਂ ਇਲਾਵਾ ਇਸ ਵਿੱਚ ਕੋਈ ਜ਼ਿਆਦਾ ਖ਼ਾਸ ਫ਼ਰਕ ਨਹੀਂ ਅਤੇ ਨਾ ਹੀ ਇਸ ਵਿੱਚ ਕੋਈ ਖ਼ਾਸ ਫ਼ਰਕ ਕੀਤਾ ਜਾ ਸਕਦਾ ਹੈ